ਘਰ ਵਿੱਚ ਅਸੀਂ ਅਕਸਰ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਬਣਾਉਂਦੇ ਹਾਂ ਉਹ ਉਹਨਾਂ ਵਿੱਚ ਇੱਕ ਹੈ ਚਾਹ ਹੈ ਨਾ ਫਿਰ ਆ ਜਾਂਦੀ ਕੌਫੀ ਸਰਦੀਆਂ ਦੇ ਵਿੱਚ ਜ਼ਿਆਦਾਤਰ ਚਾਹ ਹੋ ਗਈ ਕੌਫੀ ਹੋ ਗਈ ਜਾਂ ਕਾੜ੍ਹਾ ਹੋ ਗਿਆ ਹੈ ਨਾ ਸਰਦੀਆਂ ਵਿੱਚ ਉਹ ਜ਼ਿਆਦਾ ਵਧੀਆ ਲੱਗਦੇ ਆ ਇਹ ਗਰਮੀਆਂ ਦੀਆਂ ਡਰਿੰਕਸ ਦੇ ਵਿੱਚ ਆਪਾਂ ਜਾਂ ਕਹਿ ਲਓ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਅਸੀਂ ਆ ਜਾਂਦੇ ਆ ਬਹੁਤ ਕੁਛ ਆ ਜਾਂਦਾ ਰੂਹ ਅਫਜਾ ਆ ਜਾਂਦਾ ਆ ਸ਼ਿਕੰਜਵੀ ਆ ਜਾਂਦੀ ਆ ਜਲ ਜੀਰਾ ਆ ਜਾਂਦਾ ਆ ਹੈ ਨਾ ਜਾਂ ਮੈਂਗੋ ਸ਼ੇਕ ਹੋ ਗਿਆ ਬਨਾਨਾ ਸ਼ੇਕ ਹੈ ਨਾ ਜਾਂ ਠੰਡਾ ਠੰਡਾਈ ਜਿਹਨੂੰ ਕਹਿ ਲੈਂਦੇ ਆ ਹੈ ਨਾ ਦੁੱਧ ਪਾ ਕੇ ਸ਼ਰਬਤ ਬਣਾ ਲਈ ਦੀ ਆ ਠੀਕ ਹੈ ਹੋਰ ਅੱਜ ਕੱਲ੍ਹ ਨਵੇਂ ਨਵੇਂ ਮਿਲ ਜਾਂਦੇ ਹੈਗੇ ਬਾਹਰੋਂ ਤੁਹਾਨੂੰ ਪੈਕਜ ਪੈਕਡ ਮਸਾ ਫਲੇਵਰਸ ਜਿਹਦੇ ਵਿੱਚ ਅਸੀਂ ਨਿੰਬੂ ਪਾਣੀ ਹੈ ਨਾ ਨਿੰਬੂ ਪਾਣੀ ਅਕਸਰ ਬਣਾ ਲੈਂਦੇ ਹਾਂ ਅਤੇ ਹੋਰ ਜ਼ਿਆਦਾਤਰ ਅਸੀਂ ਆਹੀ ਚੀਜ਼ਾਂ ਜਿਹੜੀਆਂ ਹੈਗੀਆਂ ਪੀਣ ਵਾਲੀਆਂ ਉਹ ਵਰਤਦੇ ਹਾਂ ਅਤੇ ਇਹਦੇ ਨਾਲ ਗਰਮੀਆਂ ਦੇ ਮੌਸਮ ਦੇ ਅਕੋਰਡਿੰਗ ਹੈ ਕਿ ਜਿਹੜੀ ਚੀਜ਼ਾਂ ਵੱਖ ਵੱਖ ਹੈਗੀਆਂ ਉਹ ਆਪਾਂ ਮੌਸਮ ਦੇ ਅਕੋਰਡਿੰਗ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੱਖ ਵੱਖ ਬਣਾਉਂਦੇ ਹਾਂ